ਯੋਗਾ ਦੇ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਤਾ ਹੈ ਯੋਗਾ ਦੀ ਜਿਵੇਂ ਸਾਡੀ ਸਾਡੀ ਯੋਗਾ ਸਾਡੀ ਸਾਡੀ ਬਹੁਤ ਕੁਛ ਦਿੰਦਾ ਜਿਵੇਂ ਅਸੀਂ ਯੋਗਾ ਕਰਦੇ ਹਾਂ ਇਸ ਨਾਲ ਅਸੀਂ ਫਿੱਟ ਰਹਿੰਦੇ ਹਾਂ ਅਸੀਂ ਆਪਣੀ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੈ ਤੁਹਾਨੂੰ ਇੱਕ ਉਦਾਹਰਨ ਦੱਸਦੀ ਹਾਂ ਵੀ ਮੇਰੇ ਮੰਮੀ ਜਿਵੇਂ ਉਹਨਾਂ ਉ ਉਹਨਾਂ ਦੇ ਨਾ ਅਧਰੰਗ ਦਾ ਅਟੈਕ ਹੋ ਗਿਆ ਸੀ ਜਿਵੇਂ ਫੇਸ 'ਤੇ ਇੱਕ ਆਈਜ 'ਤੇ ਮਤਲਬ ਅਟੈਕ ਹੋ ਗਿਆ ਸੀ ਅਧਰੰਗ ਦਾ ਬੈਠੇ ਬੈਠਿਆ ਨੂੰ ਅਤੇ ਜਦੋਂ ਮਤਲਬ ਸਾਨੂੰ ਨਹੀਂ ਪਤਾ ਸੀ ਅਧਰੰਗ ਦਾ ਅਟੈਕ ਹੋ ਗਿਆ ਅਸੀਂ ਉਹਨਾਂ ਨੂੰ ਮੈਂ ਉਹਨਾਂ ਨੂੰ ਕਿਹਾ ਵੀ ਇਹ ਕੀ ਹੋ ਗਿਆ ਉਹ ਕਹਿੰਦੇ ਵੀ ਪਤਾ ਨਹੀਂ ਕੀ ਹੋ ਗਿਆ ਵੀ ਐਂ ਟੇਡਾ ਹੋ ਗਿਆ ਫੇਸ ਸਾਨੂੰ ਪਤਾ ਹੀ ਨਹੀਂ ਸੀ ਕੁਛ ਵੀ ਫਿਰ ਅਸੀਂ ਮੈਂ ਆਪਣੀ ਮੰਮੀ ਨੂੰ ਡਾਕਟਰ ਕੋਲ ਲੈ ਕੇ ਗਈ ਉਹ ਡਾਕਟਰ ਨੇ ਦੱਸਿਆ ਵੀ ਮੈਂ ਮੈਡੀਸਨ ਦੇਵਾਂਗਾ ਅਤੇ ਨਾਲ ਨਾਲ ਮੈਂ ਤੁਹਾਨੂੰ ਯੋਗਾ ਦੱਸੂਗਾ ਇੱਕ ਜਿਹਦੇ ਨਾਲ ਵੀ ਤੁਹਾਨੂੰ ਇਹਦਾ ਇਫੈਕਟ ਹੋਵੇਗਾ ਮੈਡੀਸਨ ਦਾ ਯੋਗਾ ਦੇ ਨਾਲ ਨਾਲ ਫਿਰ ਹੀ ਹੋਵੇਗਾ ਜੇ ਯੋਗਾ ਕਰੂੰਗੇ ਫਿਰ ਹੀ ਮੈਡੀਸਨ ਦਾ ਇਫੈਕਟ ਹੋਣਾ ਫਿਰ ਉਹਨਾਂ ਨੇ ਇੱਕ ਮਤਲਬ ਇੱਕ ਯੋਗਾ ਦੱਸਿਆ ਮੇਰੇ ਮੰਮਾ ਨੂੰ ਵੀ ਤੁਸੀਂ ਮੂੰਹ ਫੁਲਾਉਣਾ ਹੈਗਾ ਇੱਕ ਮੂੰਹ ਫੁਲਾਉਣਾ ਹੈਗਾ ਜਿਵੇਂ ਅੱਖ 'ਤੇ ਵੀ ਅਸਰ ਕਰੇ ਮੂੰਹ ਇੰਨਾ ਫੁਲਾਉਣਾ ਹੈਗਾ ਅਤੇ ਵਿੱਚ ਉਹਨਾਂ ਨੇ ਵੀ ਪੰਜ ਦਿਨਾਂ ਦੀ ਮੈਡੀਸਨ ਖਾਦੀ ਨਾਲ ਨਾਲ ਯੋਗਾ ਕੀਤਾ ਜਿਵੇਂ ਡਾਕਟਰ ਨੇ ਦੱਸਿਆ ਸੀਗਾ ਉਸ ਯੋਗੇ ਦੇ ਨਾਲ ਪੰਜ ਦਿਨਾਂ ਵਿੱਚ ਅਸੀਂ ਹਰਾ ਅਸੀ ਹੈਰਾਨ ਹੋ ਗਏ ਵੀ ਇਹ ਪੰਜ ਦਿਨਾਂ ਦੇ ਵਿੱਚ ਵੀ ਐਂ ਕਿਵੇਂ ਫੇਸ ਸਹੀ ਹੋ ਸਕਦਾ ਅੱਖ ਝਪਕਦੀ ਨਹੀਂ ਸੀ ਅੱਖ ਖੜ ਗਈ ਸੀ ਮਤਲਬ ਅੱਖ ਵੀ ਝਪਕਣ ਲੱਗ ਗਈ ਅਤੇ ਮਤਲਬ ਵੀ ਫੇਸ ਵੀ ਸਿੱਧਾ ਹੋ ਗਿਆ ਠੀਕ ਮਾਮੂਲੀ ਜਿਹਾ ਰਹਿ ਗਿਆ ਸੀ ਸਹੀ ਬਾਕੀ ਫਿਰ ਜਦੋਂ ਬਾਕੀ ਯੋਗਾ ਕਰੀ ਗਏ ਨਾਲ ਨਾਲ ਕੰਟੀਨਿਊ ਰੱਖਿਆ ਅਤੇ ਉਹਦੇ ਨਾਲ ਮਤਲਬ ਜਮਾ ਹੀ ਸਹੀ ਹੋ ਗਿਆ ਅਸੀਂ ਹੈਰਾਨੀ ਹੈਰਾਨ ਹੋ ਗਏ ਅਸੀਂ ਵੇਖ ਕੇ ਵੀ ਯੋਗੇ ਨਾਲ ਇੰਨਾ ਅਸਰ ਹੋ ਸਕਦਾ ਮੈਡੀਸਨ ਨਾਲ ਯੋਗਾ ਕਰਨ ਨਾਲ ਵੀ ਇਕੱਲੀ ਮੈਡੀਸਨ ਨਾਲ ਕੋਈ ਫਰਕ ਨਹੀਂ ਪੈਣਾ ਸੀਗਾ ਅਤੇ ਪਰ ਮੈਂ ਵੀ ਆਪਣੀ ਆ ਮੈਂ ਵੀ ਆਪਣਾ ਐਕਸਰਸਾਈਜ ਕਰਦੀ ਹਾਂ ਡੇਲੀ ਇਸ ਮੈਂ ਜੇ ਕੋਈ ਬਿਮਾਰੀ ਨਹੀਂ ਹੈਗੀ ਮੈਨੂੰ ਕੋਈ ਦਰਦ ਨਹੀਂ ਹੈਗਾ ਕਿਸੇ ਹਿੱਸੇ ਵਿੱਚ ਪਰ ਮੈਂ ਆਪਣੇ ਆਪ ਨੂੰ ਫਿਟ ਰੱਖਣ ਲਈ ਮੈਂ ਐਕਸਰਸਾਈਜ ਕਰਦੀ ਹਾਂ ਜਿਸ ਨਾਲ ਕਿ ਮੈਂ ਬਹੁਤ ਫਿਟ ਹਾਂ